ਬਜਟ ਦੇ ਅਨੁਕੂਲ ਜਿਹੜੀ ਯਾਤਰਾ ਅਸੀਂ ਕੀਤੀ ਹੈ ਉਹ ਅਸੀਂ ਇੱਥੋਂ ਵ੍ਰਿੰਦਾਵਨ ਧਾਮ ਦੀ ਯਾਤਰਾ ਕੀਤੀ ਹੈ ਔਰ ਯਾਤਰਾ ਦੇ ਵਿੱਚ ਸਾਨੂੰ ਬਹੁਤ ਹੀ ਮਜ਼ਾ ਆਇਆ ਉਹ ਯਾਤਰਾ ਦੇ ਵਿੱਚ ਸਾਡਾ ਬਜਟ ਜਿਹੜਾ ਸੀ ਉਸ ਬਜਟ ਦੇ ਅਨੁਸਾਰ ਹੀ ਅਸੀਂ ਆਪਣਾ ਘੁੰਮੇ ਔਰ ਸਾਡਾ ਬਜਟ ਦੇ ਅਨੁਸਾਰ ਹੀ ਸਾਰਾ ਖਰਚਾ ਹੋਇਆ ਉੱਥੇ ਬਹੁਤ ਹੀ ਬੱਚਿਆਂ ਨੇ ਬਹੁਤ ਹੀ ਸਾਡਿਆਂ ਨੇ ਇੰਜੋਏ ਕੀਤਾ ਔਰ ਅਸੀਂ ਮੰਦਰਾਂ 'ਚ ਗਏ ਮੰਦਰਾਂ 'ਚ ਸਾਨੂੰ ਬਹੁਤ ਮਜ਼ਾ ਆਇਆ ਔਰ ਯਾਤਰਾ ਦੇ ਵਿੱਚ ਅਸੀਂ ਵੇਖਿਆ ਕਿ ਉੱਥੇ ਕਾਫੀ ਰਸ਼ ਹੈਗਾ ਸੀ ਇੱਕ ਮੰਦਰਾਂ ਦੇ ਵਿੱਚ ਜਾਣ ਵਸਤੇ ਲੰਬੀਆਂ ਲੰਬੀਆਂ ਲੈਨਾਂ ਲੱਗੀਆਂ ਹੋਈਆਂ ਸਨ ਔਰ ਅਸੀਂ ਅਸੀਂ ਮੰਦਰਾਂ ਦੇ ਵਿੱਚ ਦੇਖਿਆ ਕਿ ਉੱਥੇ ਬਹੁਤ ਜ਼ਿਆਦਾ ਰਸ਼ ਸੀ ਅਸੀਂ ਉੱਥੇ ਬਜ਼ਾਰਾਂ ਦੇ ਵਿੱਚ ਘੁੰਮੇ ਔਰ ਬਹੁਤ ਸਾਰੀਆਂ ਦੁਕਾਨਾਂ ਉੱਥੇ ਵੇਖਣ ਨੂੰ ਮਿਲੀਆਂ ਔਰ ਬੜਾ ਆਪਣਾ ਜਿਹੜਾ ਅਸੀਂ ਘਰ ਦੇ ਵਿੱਚ ਆਪਣਾ ਇਹ ਲੱਡੂ ਗੋਪਾਲ ਜੀ ਰੱਖੇ ਹੋਏ ਨੇ ਜਿਨ੍ਹਾਂ ਦਾ ਸਮਾਨ ਸਾਰਾ ਸ਼ਿੰਗਾਰ ਸ਼ਿੰਗੁਰ ਦਾ ਸਭ ਉਹ ਦੁਕਾਨਾਂ 'ਤੇ ਵੇਖਣ ਨੂੰ ਮਿਲਦਾ ਹੈ ਇਹੋ ਜਿਹਾ ਸਮਾਨ ਸਾਡੇ ਆਪਣੇ ਇੱਥੇ ਸ਼ਹਿਰ ਦੇ ਵਿੱਚ ਵੇਖਣ ਨੂੰ ਨਹੀਂ ਮਿਲਦਾ ਔਰ ਯਾਤਰਾ ਦੇ ਵਿੱਚ ਜਾ ਕੇ ਸਾਨੂੰ ਬਹੁਤ ਮਜ਼ਾ ਆਇਆ ਉੱਥੇ ਜਾ ਕੇ ਅਸੀਂ ਪਹਿਲੇ ਮੰਦਰਾਂ ਦੇ ਦਰਸ਼ਨ ਕੀਤੇ ਫਿਰ ਉੱਥੇ ਬਜ਼ਾਰਾਂ 'ਚ ਖਾਧਾ ਪੀਤਾ ਫਿਰ ਅਸੀਂ ਆਪਣਾ ਉੱਥੇ ਜਾ ਕੇ ਦੇਖਿਆ ਕਿ ਉੱਥੋਂ ਦਾ ਵਾਤਾਵਰਨ ਬਹੁਤ ਹੀ ਸਾਫ ਔਰ ਸਵੱਛ ਹੈ ਔਰ ਉੱਥੇ ਘੁੰਮਣਾ ਸਾਨੂੰ ਬਹੁਤ ਹੀ ਵਧ ਵਧੀਆ ਲੱਗਦਾ ਹੈ